ਬਾਈਕ ਦੇ ਨਾਲ ਨਾਲ ਪਰਿਵਾਰਿਕ ਜ਼ਿੰਮੇਵਾਰੀਆਂ ਵੀ ਸਾਂਭਣੀਆਂ ਬਹੁਤ ਜ਼ਰੂਰੀ ਹਨ ਕਿਉਂਕਿ ਮੈਂ ਇਸ ਨਾਲ ਬਿਲਕੁਲ ਮਤਲਬ ਕਿ ਕੋਂਪਰੋ ਕਰਦਾ ਹਾਂ ਕਿਉਂਕਿ ਕਿਸੇ ਪਰਿਵਾਰ ਦਾ ਇਕਲੌਤਾ ਮਤਲਬ ਕਿ ਜੋ ਘਰ ਦਾ ਗੁਜ਼ਾਰਾ ਕਰਦਾ ਹੈ ਉਹ ਇਕਲੌਤਾ ਹੁੰਦਾ ਜੇ ਉਹ ਹੀ ਹੁੱਲੜਬਾਜੀ ਵਿੱਚ ਮੋਟਰਸਾਈਕਲ ਚਲਾਵੇ ਕਿ ਮਤਲਬ ਕਿ ਕਾਨੂੰਨ ਦੀਆਂ ਧੱਜੀਆਂ ਉਡਾਵੇ ਆਵਾਜਾਈ ਦੇ ਸਾਧਨਾ ਦੀ ਬਲਕਿ ਵਰਤੋਂ ਕਰਦਾ ਏ ਮਤਲਬ ਕਿ ਨਜ਼ਾਇਜ ਹੀ ਕਰ ਰਿਹਾ ਹੈ ਦਾਰੂ ਪੀ ਕੇ ਚਲਾ ਰਿਹਾ ਜਾਂ ਕੁਛ ਵੀ ਕਰ ਰਿਹਾ ਉਹ ਬਹੁਤ ਹੀ ਖ਼ਤਰਨਾਕ ਚੀਜ਼ ਹੈ ਠੀਕ ਨਹੀਂ ਹੈ ਜੀ ਕਿਉਂਕਿ ਇਹ ਅਜਿਹਾ ਕੰਮ ਹੈ ਕਿ ਮਤਲਬ ਕਿ ਇਕੱਲਾ ਕਮਾਉਣ ਵਾਲਾ ਹੈ ਉਹ ਮੈਂ ਨਹੀਂ ਚਾਹੂੰਗਾ ਕਿ ਮਤਲਬ ਕਿ ਮੰਨ ਲਓ ਕਿ ਕੋਈ ਕਿਸ ਕਿਸੇ ਪਰਿਵਾਰ ਦੀਆਂ ਤਿੰਨ ਭੈਣਾਂ ਹਾਂ ਹਨ ਪੇ ਉਹਨਾਂ ਦਾ ਭਾਈ ਨਹੀਂ ਹੈ ਕੋਈ ਵੀ ਕਮਾਉਣ ਵਾਲਾ ਹੋਰ ਨਹੀਂ ਹੈ ਮਾਂ ਵੀ ਘਰ ਹਾਊਸ ਵਾਈਫ ਹੈ ਠੀਕ ਨਹੀਂ ਹੈ ਜੀ ਅਤੇ ਆਪਣਾ ਉਸ ਦਾ ਸੜਕ ਹਾਦਸੇ ਵਿੱਚ ਜੇ ਕੋਈ ਮਹੱਤਵ ਮਤਲਬ ਕਿ ਮੰਦਭਾਗੀ ਕੋਈ ਵੀ ਹਾਦਸਾ ਬੀਤ ਜਾਂਦਾ ਹੈ ਤਾਂ ਉਸ ਪਰਿਵਾਰ 'ਤੇ ਮਤਲਬ ਕਿ ਕਾਲਾ ਦਿਨ ਹੋ ਜਾਵੇਗਾ ਠੀਕ ਉਹਨਾਂ ਨੂੰ ਜਿਹੜੀਆਂ ਦੋ ਉਹਦੀਆਂ ਭੈਣਾਂ ਉਹਨਾਂ ਨੂੰ ਮਤਲਬ ਕਿ ਆਪ ਕੋਈ ਕੰਮ ਕਰਨਾ ਪਵੇਗਾ ਉਹਦਾ ਪੇ ਹੈ ਜੋ ਬੇਰ ਬਜ਼ੁਰਗ ਹੈ ਉਹ ਕੀ ਕਰਨਗੇ ਅਜਿਹੀ ਅਵਸਥਾ 'ਚ ਆ ਕੇ ਕਿ ਉਨ੍ਹਾਂ ਦਾ ਇਕਲਲੌਤਾ ਜਵਾਨ ਪੁੱਤ ਕੋਈ ਤਾਂ ਕੁਛ ਕੁ ਮਤਲਬ ਕਿ ਆਪਣੇ ਮਾਪੇ ਨਹੀਂ ਇਹ ਸਦਮਾਂ ਝੱਲ ਸਕਦੇ ਉਹ ਵੀ ਚਲੇ ਜਾਂਦੇ ਹਨ ਬਚ ਜਾਂਦੇ ਹਨ ਤਾਂ ਮੈਂ ਤਾਂ ਇਹ ਹੀ ਉਮੀਦ ਕਰੂੰਗਾ ਕਿ ਜੇ ਮੈਂ ਹੋਵਾਂ ਉਹਨਾਂ ਦੀ ਜਗ੍ਹਾ ਤਾਂ ਮੈਂ ਆਪਣੇ ਕਾਨੂੰਨ ਦੇ ਨਜ਼ਰ ਅੰਦਾਜ਼ 'ਚ ਰਹਿ ਕੇ ਕਿ ਆਪਣਾ ਆਵਾਜਾਈ ਦਾ ਚਲਾਉਂਗਾ ਕਿ ਮੈਂ ਉਸਦਾ ਕਦੇ ਵੀ ਗਲਤ ਅਫਸੋਸ ਨਹੀਂ ਕਰਾਂਗਾ ਕਿ ਆਪਣਾ ਸੇਫਟੀ 'ਚ ਰਹਿ ਕੇ ਹੈਲਮਟ ਜ਼ਰੂਰ